ਨਮਸਕਾਰ ਜੀ ਅੱਛਾ ਜੀ ਭਾਅ ਜੀ ਮੈ ਮਾਨਸਾ ਸ਼ਹਿਰ ਦਾ ਨਿਵਾਸੀ ਹਾਂ ਮੈਂ ਇੱਥੋਂ ਦਾ ਤੁਹਾਨੂੰ ਦੱਸ ਸਕਦਾ ਮੇਰੇ ਕਾਫੀ ਫਰੈਂਡਸ ਦੇ ਪੇਰੈਂਟ ਨੇ ਜੋ ਕਿ ਟੀਚਰ ਲੱਗੇ ਹੋਏ ਨੇ ਮੈਨੂੰ ਉਹਨਾਂ ਤੋਂ ਹੀ ਜਿਹੜਾ ਕੁਝ ਸੁਣਨ ਨੂੰ ਮਿਲਦਾ ਹੈਗਾ ਕਹਿੰਦੇ ਇਸ ਟਾਈਮ 'ਤੇ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਹੈ ਨਾ ਸਮਾਰਟ ਸਕੂਲ ਬਣਾਉਣਾ ਜਾਂ ਫਿਰ ਬੱਚਿਆਂ ਨੂੰ ਉਸ ਤਰੀਕੇ ਦੀ ਐਜੂਕੇਸ਼ਨ ਦੇਣਾ ਕਿ ਜੋ ਕਿ ਰੀਅਲ ਲਾਈਫ ਦੇ ਵਿੱਚ ਕੰਮ ਆ ਪਾਵੇ ਹੈ ਨਾ ਬੱਚਿਆਂ ਨੂੰ ਜਿਹੜੇ ਪਹਿਲਾਂ ਕੋਚਿੰਗ ਇੰਸਟੀਟਿਊਟ ਜਾਂਦੇ ਸੀ ਉਹਨਾਂ ਨੂੰ ਕਹਿ ਕੇ ਵੀ ਨਹੀਂ ਕੋਚਿੰਗ ਇੰਸਟੀਚਿਊਟ ਨਾ ਜਾ ਕੇ ਸਕੂਲਾਂ ਦੇ ਵਿੱਚ ਉਸ ਤਰੀਕੇ ਦੀ ਪੜ੍ਹ ਪੜ੍ਹਾਈ ਕਰਵਾਉਣਾ ਹੈ ਨਾ ਹਾਂਜੀ ਬਿਲਕੁਲ ਬਿਲਕੁਲ ਭਾਅ ਜੀ ਭਾਅ ਜੀ ਉਹ ਭਾਅ ਜੀ ਉਹੀ ਹੈ ਵੀ ਕਹਿੰਦੇ ਵੀ ਜਿਹੜਾ ਮਿਡ ਡੇ ਮੀਲ ਦਿੱਤਾ ਜਾ ਰਿਹਾ ਹੈਗਾ ਬੱਚਿਆਂ ਨੂੰ ਕੁਆਲਿਟੀ ਬਹੁਤ ਵਧੀਆ ਦਿੱਤੀ ਜਾ ਰਹੀ ਹੈ ਅਤੇ ਗਰੀਬ ਬੱਚਿਆਂ ਨੂੰ ਥੋੜ੍ਹਾ ਇਨਸੈਂਟਿਵਜ ਦਿੱਤਾ ਜਾਵੇ ਵੀ ਤੁਸੀਂ ਸਕੂਲ ਆਓ ਕਿਉਂਕਿ ਹਰ ਇੱਕ ਬੰਦਾ ਸਕੂਲ 'ਚ ਪਾਉਣ ਦੇ ਕਾ ਕਾਬਲ ਨਹੀਂ ਹੁੰਦਾ ਆਪਦੇ ਜਵਾਕ ਨੂੰ ਹੈ ਨਾ ਲੇਕਿਨ ਉਹਨਾਂ ਨੂੰ ਦੱਸਣਾ ਕਿ ਨਹੀਂ ਹਰ ਇੱਕ ਚੀਜ਼ ਸਕੂਲ ਪ੍ਰੋਵਾਈਡ ਕਰ ਰਿਹਾ ਬੁੱਕਸ ਤੋਂ ਲੈ ਕੇ ਖਾਣੇ ਤੋਂ ਲੈ ਕੇ ਸਾਈਕਲ ਤੱਕ ਵੱਡੇ ਹੋ ਕੇ ਲੈਪਟੋਪ ਤੱਕ ਪ੍ਰੋਵਾਈਡ ਕਰਦੇ ਨੇਗੇ ਹੈ ਨਾ ਤਾਂ ਉਹ ਕਿਤੇ ਨਾ ਕਿਤੇ ਗਰੀਬ ਬੰਦੇ ਨੂੰ ਐਂ ਨਹੀਂ ਹੈਗਾ ਵੀ ਜੇ ਮੈਂ ਪੜ੍ਹਾਉਂਗਾ ਤਾਂ ਉਹ ਮਾਰ ਪਊਗੀ ਮੈਨੂੰ ਜੇ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈ ਸਰਕਾਰ ਇੱਕ ਸੁਵਿਧਾ ਦੇ ਰਹੀ ਹੈ ਜਿਸ ਕਰਕੇ ਗਰੀਬ ਬੱਚਾ ਸਕੂਲ ਜਾਣ ਲਈ ਪ੍ਰੇਰਿਤ ਹੋ ਰਿਹਾ ਹੈਗਾ ਬਿਲਕੁਲ ਭਾਅ ਜੀ ਇਸ ਵਾਰ ਤੁਸੀਂ ਦੇਖੋ ਦੋ ਪਰਸੈਂਟ ਪੰਜਾਬ ਦੀ ਪਾਪੂਲੇਸ਼ਨ ਹੈ ਸਤਾਰ੍ਹਾਂ ਪਰਸੈਂਟ ਓਲੰਪਿਕ ਦੇ ਖਿਡਾਰੀ ਖਿਲਾੜੀ ਹੈ ਇਹ ਤਾਂ ਹੀ ਹੋ ਪਾ ਰਿਹਾ ਕਿਉਂਕਿ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਕਿਹਾ ਜਾ ਰਿਹਾ ਇਨੀਸ਼ਏਟ ਕੀਤਾ ਜਾ ਰਿਹਾ ਵੀ ਸਪੋਰਟ ਦੇ ਵਿੱਚ ਪਾਟ ਲਓ ਕਿਤੇ ਨਾ ਕਿਤੇ ਇੱਕ ਸਪੋਰਟਸ ਨੂੰ ਚੁਣਨਾ ਜ਼ਰੂਰੀ ਹੋ ਹੋ ਗਿਆ ਬੱਚਿਆਂ ਲਈ ਹਾਂਜੀ ਹਾਂ ਭਾਅ ਜੀ ਜਿਵੇਂ ਹੁੰਦਾ ਵੀ ਇ ਕਦੇ ਬੱਚਿਆਂ ਨੂੰ ਕਹਿੰਦੇ ਵੀ ਡਾਇਟ 'ਤੇ ਲਿਖ ਕੇ ਲੈ ਕੇ ਆਓ ਕਦੇ ਕਿਸੇ ਸਪੋਰਟ 'ਤੇ ਲਿਖ ਕੇ ਲੈ ਕੇ ਆਓ ਕਦੇ ਕਿਸੇ ਸ਼ਖਸੀਅਤ 'ਤੇ ਲਿਖ ਕੇ ਲੈ ਕੇ ਆਓ ਹੈ ਨਾ ਤਾਂ ਜਿਹਦੇ ਨਾਲ ਬੱਚੇ ਨੂੰ ਪਤਾ ਲੱਗਦਾ ਹੈਗਾ ਕੋਈ ਚਾਰਟ ਬਣਾਉਣ ਨੂੰ ਦੇ ਤੇ ਕਈ ਵਾਰ ਹੈ ਨਾ ਉਹ ਫਿਰ ਉਹਨਾਂ ਨੂੰ ਸਕੂਲ ਦੀ ਕਲਾਸ ਦੇ ਵਿੱਚ ਲਗਾਉਣਾ ਤਾਂ ਇਹੀਆਂ ਚੀਜ਼ਾਂ ਹੈ ਜੋ ਕਿ ਇੱਕ ਬੰਦਾ ਕੰਮ ਕਰਦਾ ਲੇਕਿਨ ਦਸ ਬੰਦੇ ਪ੍ਰੇਰਿਤ ਹੁੰਦੇ ਆ ਉਹ ਚੀਜ਼ ਨੂੰ ਦੇਖ ਕੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਅ ਜੀ ਇਸ ਟਾਈਮ 'ਤੇ ਸਹੀ ਟਰੈਕ 'ਤੇ ਨੇ

ਧੰਨਵਾਦ ਜੀ ਓਕੇ